ਮੋਹਾਲੀ ਜ਼ਿਲ੍ਹੇ ਵਿੱਚ ਆਮ ਕੁਝ ਆਮ ਸਮਾਜਿਕ ਜਾਂ ਸੱਭਿਆਚਾਰਾਂ ਰੀਤੀ ਰਿਵਾਜ਼ ਮਨਾਏ ਜਾਂਦੇ ਹਨ ਜਿਵੇਂ ਕਿ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਗੁੜਤੀ ਦਿੱਤੀ ਜਾਂਦੀ ਹੈ ਗੁੜਤੀ ਉਹ ਦਿੰਦਾ ਹੈ ਜੋ ਕਿ ਸਭ ਤੋਂ ਵਧੀਆ ਹੁੰਦਾ ਹੈ ਜਿਵੇਂ ਕਿ ਰਹਿਣ ਸਹਿਣ ਅਤੇ ਪਹਿਰਾਵਾ ਅਤੇ ਬ ਅਤੇ ਉਸਦਾ ਵਿਆਹ ਹੁੰਦਾ ਹੈ ਵਿਆਹ ਤੋਂ ਪਹਿਲਾਂ ਬਟਨਾ ਲਗਾਇਆ ਜਾਂਦਾ ਹੈ ਅਤੇ ਫਿਰ ਅਗਲੇ ਦਿਨ ਨਹਾਈ ਧੋਈ ਕੀਤੀ ਜਾਂਦੀ ਹੈ ਨਹਾਈ ਧੋਈ ਕਰਨ ਤੋਂ ਬਾਅਦ ਉਸ ਨੂੰ ਤਿਆਰ ਕੀਤਾ ਜਾਂਦਾ ਹੈ ਅਤੇ ਤਿਆਰ ਕਰਨ ਤੋਂ ਬਾਅਦ ਬਰਾਤ ਨੂੰ ਤੋਰਿਆ ਜਾਂਦਾ ਹੈ ਬਰਾਤ ਤੋਰਨ ਤੋਂ ਬਾਅਦ ਆਨੰਦ ਕਾਰਜ ਹੁੰ ਗੁਰੂ ਘਰ ਆਨੰਦ ਕਾਰਜ ਹੁੰਦੇ ਹਨ ਅਤੇ ਘਰ ਆ ਕੇ ਸਿਰ ਤੋਂ ਪਾਣੀ ਵਾਰਿਆ ਜਾਂਦਾ ਹੈ ਅਤੇ ਅਗਲੇ ਦਿਨ ਅਗਲੇ ਦਿਨ ਕੰਗਣਾ ਖਿਡਾਇਆ ਜਾਂਦਾ ਹੈ ਅਤੇ ਗੁਰੂ ਘਰ ਮੱਥਾ ਟੇਕਵਾਇਆ ਜਾਂਦਾ ਹੈ ਅਤੇ ਮੌਤ ਦਾ ਮੌਤ ਦਾ ਵੈਨ ਪਾਏ ਜਾਂਦੇ ਹਨ ਅਤੇ ਉਹ ਅਰਥੀ ਨੂੰ ਅਰਥੀ ਨੂੰ ਲੈ ਕੇ ਚਲੇ ਜਾਂਦੇ ਹਨ ਅਤੇ ਸੰਸਕਾਰ ਕਰ ਦਿੱਤਾ ਜਾਂਦਾ ਹੈ